ਪੰਜਾਬ ਪੰਜਾਬ ਵਿੱਚ ਲੋਕਾਂ ਦੇ ਜੀਵਨ ਵਿੱਚ ਕਲਾਕਾਰੀ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ ਜਿਸ ਤਰ੍ਹਾਂ ਕਿ ਆਪਾਂ ਕੋਈ ਤਿਉਹਾਰ ਹੁੰਦਾ ਹੈ ਤਾਂ ਉਸ 'ਤੇ ਆਪਾਂ ਮੂਰਤੀ ਜਿਸ ਤਰ੍ਹਾਂ ਮੂਰਤੀ ਪੂਜਾ ਤਾਂ ਗਣਪਤੀ ਜੀ ਦੇ ਪਹਿਲੇ ਮੁਰ ਗਣਪਤੀ ਜੀ ਮੂਰਤੀ ਬਣਾਈ ਜਾਂਦੀ ਹੈ ਫਿਰ ਉਸ ਦੀ ਪੂਜਾ ਕਰੀ ਜਾਂਦੀ ਹੈ ਇਸ ਤਰ੍ਹਾਂ ਹੀ ਸਾਡੇ ਇੱਥੇ ਇੱਕ ਹੁੰਦਾ ਹੈ ਜੋ ਦੇਵੀ ਵਾਸਤੇ ਪੂਜਿਆਂ ਜਾਂਦਾ ਹੈ ਨਵਰਾਤਰਿਆਂ 'ਚ ਦੇਵੀ ਨੂੰ ਘਰੇ ਲਿਆਇਆ ਜਾਂਦਾ ਹੈ ਔਰ ਦੇਵੀ ਦੀ ਮੂਰਤੀ ਦੀਵਾਰ ਦੇ ਉੱਪਰ ਬਣਾਈ ਜਾਂਦੀ ਹੈ ਗੋਬਰ ਔਰ ਮਿੱਟੀ ਦੇ ਨਾਲ਼ ਮਿਕਸ ਕਰਕੇ ਬਹੁਤ ਸੁੰਦਰ ਉਹ ਤਰ੍ਹਾਂ ਬਣਾਈ ਜਾਂਦੀ ਹੈ ਫਿਰ ਉਸ ਨੂੰ ਆਪਾਂ ਆਪਣੀ ਇੱਕ ਹਫ਼ਤਾ ਪੂਜਾ ਕਰਦੇ ਹਾਂ ਉਸ ਤੋਂ ਬਾਅਦ ਆਪਾਂ ਟੋਭੇ 'ਚ ਜਾਂ ਕਿਤੇ ਜਾ ਕੇ ਨਹਿਰ 'ਚ ਵਧਾ ਕੇ ਆਉਂਦੇ ਹਾਂ ਇਸ ਤਰ੍ਹਾਂ ਹੀ ਹੋਰ ਵੀ ਕਈ ਤਰ੍ਹਾਂ ਦੇ ਜਿਸ ਤਰ੍ਹਾਂ ਹੈਗੇ ਹੈ ਫੰਕਸ਼ਨ ਜਿਸ ਤਰ੍ਹਾਂ ਦੁਸ਼ਹਿਰੇ ਦੁਸ਼ਹਿਰੇ ਨੂੰ ਰਾਵਣ ਦੇ ਦਸ ਸਿਰ ਬਣਾਏ ਜਾਂਦੇ ਆ ਫਿਰ ਉਹਨਾਂ ਦੀ ਪੂਜਾ ਕਰੀ ਜਾਂਦੀ ਹੈ ਫਿਰ ਉਹਨਾਂ ਤੋਂ ਬਾਅਦ ਉਹਨਾਂ ਨੂੰ ਵੀ ਵਧਾ ਦਿੱਤਾ ਜਾਂਦਾ ਹੈ ਕਿਸੇ ਪਾਣੀ ਕਿਸੇ ਚਲਦੇ ਪਾਣੀ 'ਚ ਇਸ ਤਰ੍ਹਾਂ ਬਹੁਤ ਸਾਰੇ ਉਹ ਫੈਸਟੀਵਲ ਹੁੰਦੇ ਹੈ ਜੋ ਆਮ ਤੌਰ 'ਤੇ ਜਿਸ ਤਰ੍ਹਾਂ ਕੋਈ ਨਵੀਂ ਚੀਜ਼ ਘਰ 'ਚ ਲਿਆਂਈ ਜਾਂਦੀ ਹੈ ਤਾਂ ਉਹਨਾਂ ਦੇ ਉੱਪਰ ਸਵਾਸਤਿਕ ਬਣਾਇਆ ਜਾਂਦਾ ਹੈ ਜੋ ਕਿ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਨਵੇਂ ਘਰ ਜਾਂ ਨਵੀਂ ਗੱਡੀ ਦੇ ਉੱਪਰ ਆਪਾਂ ਸਵਾਸਤਿਕ ਬਣਾਉਂਦੇ ਹਾਂ ਉਹ ਬਹੁਤ ਏ ਅੱਛਾ ਹੁੰਦਾ ਹੈ ਇਹ ਪੰਜਾਬੀ ਲੋਕਾਂ ਦੀ ਮੇਨ ਜੋ ਹੈ